ਵੱਧ ਮੈਨੂੰ ਸਧਾਰਨ ਮੁਰਗ ਪੰਛੀ ਲੱਗਦਾ ਬਹੁਤ ਵਧੀਆ ਅਸੀਂ ਚਿੜੀਆ ਘਰ 'ਚ ਪੰਛੀ ਵੇਖਣ ਗਏ ਅਤੇ ਬਹੁਤ ਸਾਨੂੰ ਪੰਛੀ ਮਿਲੇ ਅਤੇ ਛਤਰ ਮੁਰਗ ਸਾਨੂੰ ਬਹੁਤ ਵਧੀਆ ਲੱਗਿਆ ਅਤੇ ਪੰਛੀ ਹੋਰ ਵੀ ਸੀ ਕੁੜੀਆਂ ਚਿੜੀਆਂ ਦੇ ਨਾਲ ਜਵਾਕਾਂ ਦੇ ਨਾਲ ਵੇਖਣ ਗਏ ਅਸੀਂ ਬਹੁਤ ਜੀਅ ਮੈਨੂੰ ਲੱਗਿਆ ਸਾਨੂੰ ਵੇਖ ਕੇ ਮਨ ਖੁਸ਼ ਹੋਇਆ ਛਤਰ ਮੁਰਗ ਹੈ ਸਾਨੂੰ ਲੰਬੀਆਂ ਉੱਚੀਆਂ ਲੱਤਾਂ ਅਤੇ ਛੋਟਾ ਜਿਹਾ ਮੂੰਹ ਵੇਖਣ 'ਚ ਬਹੁਤ ਵਧੀਆ ਲੱਗਿਆ ਅਤੇ ਬਹੁਤ ਦੂਰ ਤੱਕ ਅਸੀਂ ਘੁੰਮ ਕੇ ਵੇਖਿਆ ਬਹੁਤ ਜਾਨਵਰ ਸੀਗੇ ਸਾਰੇ ਜਾਨਵਰਾਂ 'ਚ ਸਾਨੂੰ ਛਤਰ ਮੁਰਗ ਵਧੀਆ ਲੱਗਿਆ ਅਤੇ ਵਧੀਆ ਹੀ ਸਾਨੂੰ ਦੂਜੇ ਜਿਹੜੇ ਪੰਛੀ ਸੀ ਉਹ ਵੀ ਬਹੁਤ ਵਧੀਆ ਲੱਗੇ ਜੋ ਚਿੜੀਆਂ ਸੀ ਤੋਤੇ ਸੀ ਬਹੁਤ ਜਾਨਵਰ ਸੀਗੇ ਅਸੀਂ ਸਾਰੇ ਵਧੀਆ ਦੇਖ ਕੇ ਅੰਦਰ ਲੈ ਕੇ ਆਏ ਅਤੇ ਵਧੀਆ ਸਾਨੂੰ ਚਿੜੀਆਂ ਘਰ 'ਚ ਦੇਖ ਕੇ ਅਤੇ ਉਹਨਾਂ ਪੰਛੀਆਂ 'ਤੇ ਸਾਡਾ ਮਨ ਖੁਸ਼ ਹੋਇਆ ਅਤੇ ਵਧੀਆ ਹੀ ਅਸੀਂ ਵੇਖੇ